ਜਿਸ ਵਿੱਚ ਸਭ ਸਿੱਖਿਆ ਦਾ ਪ੍ਰਚਾਰ ਆਧੁਨਿਕ ਸਹਿਤ ਸਹੂਲਤਾਂ ਹਰ ਪਿੰਡ ਵਿੱਚ ਸਿਹਤ ਕੇਂਦਰ ਦੀ ਸਥਾਪਨਾ ਹੋਵੇ ਸਾਫ਼ ਸਫਾਈ ਅਤੇ ਪਾਣੀ ਦੀ ਸਪਲਾਈ ਹੋਵੇ ਘਰ ਘਰ ਵਿੱਚ ਸ਼ੋਚਾਲਯਾ ਦਾ ਪ੍ਰਬੰਧ ਹੋਵੇ ਬਿਜਲੀ ਅਤੇ ਰੋਸ਼ਨੀ ਦਾ ਸੁਧਾਰ ਹੋਵੇਗਾ ਬਿਜਲੀ ਸਪਲਾਈ ਅਤੇ ਸਟਰੀਟ ਲਾਈਟਾਂ ਵਿੱਚ ਊਰਜਾ ਵਰਗੀਆਂ ਚੋਣਾਂ ਹੋਣੀਆਂ ਹੋਣੀਆਂ ਚਾਹੀਦੀਆਂ ਹਨ ਇੰਨਫਰਾਸਟਕਚਰ ਵਿਕਾਸ ਹੋਣਾ ਚਾਹੀਦਾ ਹੈ ਇਹਦੇ ਵਿੱਚ ਪੱਕੀਆਂ ਸੜਕਾਂ ਅਤੇ ਜਿਸ ਨਾਲ ਸਾਜੋ ਸਮਾਨ ਦੀ ਵਧੀਆ ਪਹੁੰਚ ਹੋ ਸਕੇ ਪਿੰਡਾਂ ਨੂੰ ਡਿਜੀਟਲ ਬਣਾਉਣਾ ਚਾਹੀਦਾ ਹੈ ਇੰਟਰਨੈਟ ਦੀਆਂ ਕਨੈਕਟੀਵਿਟੀਆਂ ਦੇਣੀਆਂ ਚਾਹੀਦੀਆਂ ਹਨ ਆਨਲਾਈਨ ਸਰਕਾਰੀ ਸੇਵਾਵਾਂ ਦੀ ਪਹੁੰਚ ਹੋਣੀ ਚਾਹੀਦੀ ਹੈ ਰੋਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਹਨ ਪਿੰਡਾਂ ਵਿੱਚ ਛੋਟੇ ਉਦਯੋਗਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਮਹਿਲਾਵਾਂ ਅਤੇ ਨੌਜਵਾਨਾਂ ਲਈ ਟ੍ਰੇਨਿੰਗ ਸੈਂਟਰ ਹੋਣੇ ਚਾਹੀਦੇ ਹਨ ਅਤੇ ਸਥਾਨਕ ਭਾਗੀਦਾਰੀ ਵੀ ਹੋਣੀ ਚਾਹੀਦੀ ਹਨ ਜਿਨ੍ਹਾਂ ਵਿੱਚ ਲੋਕ ਜਿਹੜੇ ਸਮੱਸਿਆਵਾਂ ਤੋਂ ਜੂਝ ਰਹੇ ਹਨ ਉਹਨਾਂ ਤੇ ਕਾਰਜ ਵਿੱਚ ਸ਼ਾਮਿਲ ਕੀਤੇ ਜਾਣ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ